ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸ਼ਨ ਬੋਲ ਰਹੀ ਹਾ ਮੈਂ ਇਹ ਪੁੱਛਦੀ ਸੀ ਕਿ ਤੁਸੀਂ ਖੇਤੀ ਵਿੱਚ ਬਹੁਤ ਵਧੀਆ ਹੋਉਂਗੇ ਵੀ ਤੁਸੀਂ ਫਸਲਾਂ ਫੁਸਲਾਂ ਬਾਰੇ ਦੱਸ ਸਕਦੇ ਹੋ ਵੀ ਗਰਮੀ 'ਚ ਮੈਂ ਕਿਹੜੀ ਕਿਹੜੀ ਫਸਲ ਉਗਾ ਸਕਦੀ ਕਿਹੜੀ ਖੇਤੀ ਕਿਹਦੀ ਵਧੀਆ ਹੁੰਦੀ ਹੈ ਕਿਹਦੀ ਨਹੀਂ ਅਤੇ ਕਿਹੜੀਆਂ ਕੇ ਕਿਹੜੀਆਂ ਫਸਲਾਂ ਲਾਉਣ ਦਾ ਮੈਨੂੰ ਫਾਇਦਾ ਹਾਂਜੀ ਅੱਛਾ ਜੀ

ਅੱਛਾ ਜੀ ਹਾਂਜੀ ਮੈਂ ਵੀ ਜੀ ਹਾਂਜੀ ਹਾਂਜੀ ਮੈਂ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਮੈਂ ਹਾਂਜੀ ਇੱਦਾਂ ਹੀ ਪੁੱਛਣਾ ਚਾਹੁੰਦੀ ਸੀ ਵੀ ਮੈਂ ਹੈ ਨਾ ਉਹ ਲਗਾਈ ਸੀ ਕੱਦੂਆਂ ਦੀ ਵੇਲ ਲਾਈ ਸੀ ਫਿਰ ਉਹ ਮੱਚ ਗਈ ਜੀ ਮੈਂ ਤੁਹਾਡੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਗਾ ਵੀ ਉਹ ਬਹੁਤ ਸਫਲ ਕਿਸਾਨ ਹੈ ਵੀ ਬਹੁਤ ਵਧੀਆ ਖੇਤੀ ਕਰਦੀ ਹੈ ਮੈਂ ਵੀ ਤੁਹਾਡੇ ਵਾਂਗੂੰ ਬਣਨਾ ਚਾਹੁੰਦੀ ਹਾਂ ਹਾਂਜੀ ਹਾਂਜੀ ਉਹ ਤਾਂ ਕੋਈ ਹਾਂਜੀ ਹਾਂਜੀ ਤੁਸੀਂ ਇਸ ਕੰਮ ਵਿੱਚ ਪਏ ਕਿਵੇਂ ਕਿਸ ਤੋਂ ਸਿੱਖਿਆ ਮਿਲੀ ਇਹ ਕੰਮ ਕਰਨ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਮ ਹਾਂਜੀ ਹਾਂਜੀ ਹਾਂਜੀ ਨਹੀਂ ਬਸ ਜੀ ਤੁਹਾਡੀ ਸਲਾਹ ਲਈ ਬਹੁਤ ਧੰਨਵਾਦ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਓਕੇ